ਅਸੀਂ ਆਪਣੀ ਬਿਮਾਰੀਆਂ ਦਾ ਇਲਾਜ ਕਰਨ ਲਈ ਹਸਪਤਾਲ ਵਿੱਚ ਜਾਣਾ ਪਸੰਦ ਨਹੀਂ ਕਰਦੇ ਹਾਂ ਕੋਈ ਵੀ ਆਦਮੀ ਹੈ ਉਹ ਹਸਪਤਾਲ ਵਿੱਚ ਜਾਣਾ ਬਿਲਕੁਲ ਪਸੰਦ ਨਹੀਂ ਕਰਦਾ ਜੇ ਸਾਨੂੰ ਛੋਟੀ ਮੋਟੀ ਕੋਈ ਬਿਮਾਰੀ ਹੈ ਤਾਂ ਉਸ ਲਈ ਅਸੀਂ ਘਰੇਲੂ ਇਲਾਜ ਵਿੱਚ ਹੀ ਵਿਸ਼ਵਾਸ ਰੱਖਦੇ ਹਾਂ ਇਹ ਗੱਲ ਹੋਰ ਹੈ ਕਿ ਸਾਨੂੰ ਕੋਈ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੈ ਜੋ ਬਿਮਾਰੀ ਸਾਨੂੰ ਲੱਗ ਰਿਹਾ ਕਿ ਅਸੀਂ ਬਹੁਤ ਜ਼ਿਆਦਾ ਦਿੱਕਤ 'ਚ ਹਾਂ ਇਸ ਦਾ ਇਲਾਜ ਅਸੀਂ ਘਰੇ ਨਹੀਂ ਕਰ ਸਕਦੇ ਹਾਂ ਤਾਂ ਸਾਨੂੰ ਮਜਬੂਰੀ 'ਚ ਹਸਪਤਾਲ ਜਾਣਾ ਹੀ ਪੈਂਦਾ ਹੈ ਪਰ ਜਾਂ ਜਿੱਥੋਂ ਤੱਕ ਹੋ ਸਕੇ ਸਭ ਲੋਕ ਘਰੇ ਹੀ ਉਪਚਾਰ ਕਰਨਾ ਪਸੰਦ ਕਰਦੇ ਹਨ ਕਿਉਂਕਿ ਆਮ ਤੌਰ 'ਤੇ ਅਸੀਂ ਘਰ ਵਿੱਚ ਜਿਵੇਂ ਕਿ ਸਾਡੇ ਪੇਟ ਵਿੱਚ ਦਰਦ ਹੁੰਦੀ ਹੈ ਤਾਂ ਅਸੀਂ ਅਜਵਾਇਣ ਅਤੇ ਨਮਕ ਲੈ ਲੈਂਦੇ ਹਾਂ ਸਾਨੂੰ ਪੇਟ ਦਰਦ ਦਾ ਕਾਫੀ ਆਰਾਮ ਮਿਲਦਾ ਹੈ ਇਸੇ ਤਰ੍ਹਾਂ ਜੇ ਸਾਨੂੰ ਜੁਕਾਮ ਖਾਂਸੀ ਹੋ ਜਾਂਦੀ ਹੈ ਤਾਂ ਅਸੀਂ ਅਦਰਕ ਅਤੇ ਸ਼ਹਿਦ ਲੈ ਕੇ ਆਪਣੇ ਜੁਕਾਮ ਖਾਂਸੀ ਨੂੰ ਠੀਕ ਕਰ ਸਕਦੇ ਹਾਂ ਇਸੇ ਤਰ੍ਹਾਂ ਦਸਤ ਜਾਂ ਦਸਤ ਲੱਗਣ ਜਾਂ ਕਬਜੀ ਹੋ ਜਾਣ 'ਤੇ ਅਸੀਂ ਇਸਬਗੋਲ ਦਾ ਛਿਲਕਾ ਲੈ ਸਕਦੇ ਹਾਂ ਇਸਬਗੋਲ ਦਾ ਛਿਲਕਾ ਜੋ ਹੈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜੇ ਸਾਨੂੰ ਦਸਤ ਲੱਗੇ ਹੁੰਦੇ ਹੈ ਤਾਂ ਉਸ ਨੂੰ ਅਸੀਂ ਠੰਢੇ ਪਾਣੀ ਵਿੱਚ ਲੈ ਲੈ ਕੇ ਦਸਤ ਰੋਕ ਸਕਦੇ ਹਾਂ ਇਸ ਤਰ੍ਹਾਂ ਜੇ ਸਾਨੂੰ ਕਬਜੀ ਹੋ ਜਾਂਦੀ ਹੈ ਤਾਂ ਅਸੀਂ ਇਸਬਗੋਲ ਦੇ ਛਿਲਕੇ ਨੂੰ ਗਰਮ ਪਾਣੀ ਵਿੱਚ ਲੈ ਕੇ ਲੈ ਕੇ ਅਸੀਂ ਉਸਦਾ ਫਾਇਦਾ ਉਠਾ ਉਠਾ ਸਕਦੇ ਹਾਂ ਇਸ ਤਰ੍ਹਾਂ ਬਹੁਤ ਸਾਰੇ ਘਰੇਲੂ ਇਲਾਜ ਹਨ ਜਿਸ ਨਾਲ ਅਸੀਂ ਆਪਣੇ ਸਰੀਰ ਨੂੰ ਠੀਕ ਰੱਖ ਸਕਦੇ ਹਾਂ ਅਤੇ ਤੁਹਾਨੂੰ ਹਸਪਤਾਲ ਜਾਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ ਪਰ ਬਹੁਤ ਜ਼ਿਆਦਾ ਦਿੱਕਤ ਹੋਣ 'ਤੇ ਅਸੀਂ ਹਸਪਤਾਲ ਸਾਨੂੰ ਜਾਣਾ ਸਾਡੀ ਮਜਬੂਰੀ ਹੁੰਦੀ ਹੈ